ਮੇਰਾ ਵੀ ਕਿ ਜਿਵੇਂ ਕੰਮ ਕਾਰ ਕਰੀ ਦਾ ਰੋਜ਼ਗਾਰ ਬਿਜਲੀ 'ਤੇ ਕਾਫੀ ਹੱਦ ਤੱਕ ਡਿਪੈਂਡ ਆ ਅਤੇ ਗਰਮੀਆਂ ਦੇ ਵਿੱਚ ਜਿਹੜੇ ਹਿਸਾਬ ਨਾਲ ਕੱਟ ਵਗੈਰਾ ਲੱਗਦੇ ਨੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਅਤੇ ਮੇਰੇ ਕੋਲ ਨਾ ਜ਼ਿਆਦਾਤਰ ਕੰਮ ਜਿਵੇਂ ਦਿਨ 'ਚ ਘਰਦੇ ਕਰਨੇ ਹੁੰਦੇ ਨੇ ਸਿਲਾਈ ਵਗੈਰਾ ਨਹੀਂ ਹੁੰਦੀ ਹੈਗੀ ਜੇ ਕਦੇ ਬੈਠ ਵੀ ਜਾਉ ਸਿਲਾਈ ਕਰਨ ਤਾਂ ਬਿਜਲੀ ਦਾ ਕੱਟ ਲੱਗ ਜਾਂਦਾ ਜਿਸ ਵਜ੍ਹਾ ਨਾਲ ਸੂਈ ਵਗੈਰਾ 'ਚ ਧਾਗਾ ਨਹੀਂ ਪੈਂਦਾ ਤਰਪਾਈਆਂ ਕਰਨੀਆਂ ਵੀ ਔਖੀਆਂ ਹੋ ਜਾਂਦੀਆਂ ਨੇ ਇਸ ਲਈ ਮੇਰੇ ਕੋਲ ਇਨਵੇਟਰ ਦੀ ਲੋੜ ਤਾਂ ਹੁੰਦੀ ਆ ਇਨਵੇਟਰ ਨਾਲ ਪਰ ਸਰਦਾ ਨਹੀਂ ਹੈਗਾ ਉਹਨਾਂ ਦੀ ਬੈਟਰੀ ਛੋਟੀ ਆ ਇਸ ਕਰਕੇ ਪੱਖੇ ਵਗੈਰਾ ਚੱਲਦੇ ਨਹੀਂ ਹੈਗੇ ਇੰਨਾ ਕੁਝ ਚਲਾ ਨਹੀਂ ਸਕਦੇ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸਾਨੂੰ ਅਤੇ ਜਿੱਥੇ ਮੈਂ ਰਹਿੰਦੀ ਹਾਂ ਉੱਥੇ ਨਾ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗਦੇ ਨੇ ਅਤੇ ਇਨਵੇਟਰ ਲੋਕਾਂ ਕੋਲ ਹੈਗੇ ਤਾਂ ਹੈਗੇ ਨੇ ਬਹੁਤ ਘੱਟ ਨੇ ਅਤੇ ਬੈਟਰੀ ਵੀ ਬਹੁਤ ਛੋਟੀ ਆ ਉਹਨਾਂ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਮੈਨੂੰ